ਹੈਲੋ ਓਂਕਾਰ ਸਤਿ ਸ਼੍ਰੀ ਅਕਾਲ ਓਂਕਾਰ ਜੂਐਲਰਸ ਤੋਂ ਬੋਲਦੇ ਆਂ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਅਸੀਂ ਨਾ ਥੋੜ੍ਹਾ ਜਿਹਾ ਨਾ ਤੁਹਾਡੇ ਤੋਂ ਨਾ ਸੋਨਾ ਬਨਵਾਉਣਾ

ਉਹਦੇ ਵਿੱਚ ਕੀ ਆ ਇਹ ਨਾ ਅਸੀਂ ਲੈ ਕੇ ਜਾਣਾ ਬਾਹਰ ਹਾਂਜੀ ਬਾਹਰ ਲਿਜਾਣਾ ਵੀ ਕਹਿਣ ਦਾ ਮਤਲਬ ਜੋ ਜਿੰਨੀ ਵੀ ਅਸੀਂ ਕੁਐਂਟਿਟੀ 'ਚ ਬਣਵਾਵਾਂਗੇ ਅਤੇ ਸਾਨੂੰ ਉਸ ਕੁਐਂਟਿਟੀ ਦਾ ਕੋਈ ਵੀ ਮੰਨ ਲਓ ਸਰਟੀਫਿਕੇਟ ਚਾਹੀਦਾ ਜਾਂ ਵੀ ਉਹਦਾ ਓਰੀਜ਼ਨਲ ਬਿੱਲ ਵਗੈਰਾ ਚਾਹੀਦਾ ਅਤੇ ਜੋ ਜੀ ਜੀ

ਜੀ

ਜੀ ਮੰਨ ਲਓ ਅਸੀਂ ਤੁਹਾਡੇ ਤੋਂ ਹਾਂ ਵੀ ਕੋਈ ਐਕਸ਼ਨ ਤਾਂ ਨਹੀਂ ਹੋਏਗਾ ਮੰਨ ਲਓ ਕੱਲ੍ਹ ਨੂੰ ਕੋਈ ਸਾਨੂੰ ਪੁੱਛੇ ਕਹਿਦੇ ਵੀ ਤੁਹਾਡੇ ਕੋਲ ਇੰਨੀ ਕੁਐਂਟਿਟੀ ਦਾ ਹੈ ਜਿਹੜਾ ਵੀ ਅਸੀਂ ਉਹਨੂੰ ਬਿੱਲ ਦਿਖਾ ਦਈਏ ਕੋਈ ਬਿੱਲ ਦਾ ਇਸ਼ੂ ਤਾਂ ਨਹੀਂ ਹੋਏਗਾ ਵੀ ਕੋਈ ਕਹੇਗਾ ਵੀ ਬਈ ਜੀ ਐੱਸ ਟੀ ਵਗੈਰਾ ਦਿਓਗੇ ਜਾਂ ਵੀ ਵੈਸੇ ਟੈਂਪਰਰੀ ਦਿਓਗੇ ਹੋਲ ਮਾਰਕ ਵਾਲਾ ਦਿਓਗੇ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਨਾ ਹੋਵੇ ਵੀ ਕੋਈ ਪੁੱਛ ਲਏ ਵੀ ਤੁਸੀਂ ਇੰਨਾ ਕਿੱਥੋਂ ਲੈ ਕੇ ਆਏ ਹੋ ਜਾਂ ਕੀ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ ਹਾਂਜੀ ਹਾਂ ਵੀ ਇਸ ਤਰ੍ਹਾਂ ਦੀ ਚਾਹੀਦੀ ਵੀ ਹਾਂ ਵੀ ਰਫ਼ ਵੀ ਰਫ਼ ਨਹੀਂ ਚਾਹੀਦਾ ਸਾਨੂੰ ਪੱਕਾ ਚਾਹੀਦਾ ਹਾਂ ਹਾਂ

ਕਿਉਂ ਜੀ ਅੱਗੇ ਵੀ ਹਾਂ ਅੱਗੇ ਵੀ ਅਸੀਂ ਅਸੀਂ ਅੱਗੇ ਵੀ ਤੁਹਾਡੇ ਤੋਂ ਬਣਵਾਇਆ ਸੀ ਮੈਰਿਜ ਵੇਲੇ ਅਤੇ ਇੱਕ ਹੋਰ ਹੈ ਵੀ ਜਿਹੜੀ ਤੁਸੀਂ ਮੰਨ ਲਓ ਸਾਨੂੰ ਸੋਨਾ ਦਿਓਗੇ ਬਣਾ ਕੇ ਦਿਓਗੇ ਉਹਦੀ ਫਿਨਿਸ਼ਿੰਗ ਵੀ ਵਧੀਆ ਹੋਣੀ ਚਾਹੀਦੀ ਵੀ ਮੰਨ ਲਓ ਉਹਦੀ ਫਿਨਿਸ਼ਿੰਗ ਬਹੁਤ

ਹਾਂ ਯਾਨੀ ਕਿ ਐਨ ਵਧੀਆ ਫਿਨਿਸ਼ਿੰਗ ਹੋਣੀ ਚਾਹੀਦੀ ਹੈ ਵੀ ਦੇਖਣ 'ਚ ਨਵੇਂ ਡਿਜ਼ਾਈਨ ਹਾਂਜੀ ਵੀ ਨਵੇਂ ਡਿਜ਼ਾਈਨ ਦਾ ਹੀ ਹੋਵੇ ਕੋਈ ਓਲਡ ਨਾ ਹੋਵੇ ਅੱਛਾ ਜੀ ਚਲੋ ਕੋਈ ਗੱਲ ਨਹੀਂ ਜੀ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਠੀਕ ਹੈ ਜੀ